ਭਾਰਤ ਵਿੱਚ ਮੇਰਾ ਸਭ ਤੋਂ ਪਸੰਦੀਦਾ ਰਾਜ ਹਿਮਾਚਲ ਪ੍ਰਦੇਸ਼ ਹੈ ਇੱਥੇ ਬਹੁਤ ਹੀ ਖੂਬਸੂਰਤ ਪਹਾੜ ਹਨ ਅਤੇ ਇਹ ਬਹੁਤ ਹੀ ਖੂਬਸੂਰਤ ਰਾਜ ਹੈ ਇੱਥੇ ਬਹੁਤ ਹੀ ਖੂਬਸੂਰਤ ਮੰਦਰ ਅਤੇ ਗੁਰਦੁਆਰੇ ਵੀ ਹਨ ਇੱਥੇ ਦੀਆਂ ਜਗ੍ਹਾਵਾਂ ਬਹੁਤ ਹੀ ਪ੍ਰਸਿੱਧ ਹਨ ਅਤੇ ਕੁਝ ਮੰਦਰ ਅਤੇ ਗੁਰਦੁਆਰੇ ਵੀ ਬਹੁਤ ਪ੍ਰਸਿੱਧ ਹਨ ਕੁਛ ਪ੍ਰਸਿੱਧ ਜਗ੍ਹਾਵਾਂ ਜਿਵੇਂ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਮਨਾਲੀ ਮਨੀਕਰਨ ਸਾਹਿਬ ਅਤੇ ਹੋਰ ਵੀ ਕੁ ਬਹੁਤ ਸਾਰੇ ਮੰਦਰ ਹਨ ਜਿਵੇਂ ਚਿੰਤਪੁਰਨੀ ਜੁਆਲਾ ਜੀ ਇਹ ਆਦਿ ਹਿਮਾਚਲ ਵਿੱਚ ਹਨ ਹਿਮਾਚਲ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਹੈ ਅਤੇ ਟੂਰਿਸਟ ਪਲੇਸ ਵੀ ਹੈ ਇੱਥੇ ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਟੂਰਿਸਟ ਘੁੰਮਣ ਫਿਰਨ ਲਈ ਜਾਂਦੇ ਹਨ ਅਤੇ ਇਸ ਜਗ੍ਹਾ 'ਤੇ ਸਾਰਿਆਂ ਦਾ ਮਨ ਬਹੁਤ ਖੁਸ਼ ਹੁੰਦਾ ਹੈ ਕਿਉਂਕਿ ਇੱਥੇ ਬਹੁਤ ਹੀ ਖੂਬਸੂਰਤ ਨਜ਼ਾਰੇ ਹਨ ਅਤੇ ਹਿਮਾਚਲ ਗੁਰੂਆਂ ਪੀਰਾਂ ਦੀ ਧਰਤੀ ਵੀ ਹੈ ਅਤੇ ਮਾਤਾਵਾਂ ਦੀ ਧਰਤੀ ਵੀ ਹੈ ਹਿਮਾਚਲ ਬਹੁਤ ਹੀ ਵਧੀਆ ਰਾਜ ਹੈ ਅਤੇ ਮੈਨੂੰ ਬਹੁਤ ਹੀ ਪਸੰਦ ਹੈ